ਹੈਲੋ ਸੁਪਰ ਬਾਈਸਾਈਕਲ ਤੋਂ ਬੋਲ ਰਹੇ ਹੋ ਜੀ ਸ਼ੋਪ ਤੋਂ ਹਾਂ ਹਾਂਜੀ ਸਰ ਐਕਚੁਲੀ ਨਾ ਮੈਂ ਇੱਕ ਬਾਈਸਾਈਕਲ ਬਾਏ ਕਰਨੀ ਸੀਗੀ ਸੋ ਉਹਦੇ ਰਿਗਾਰਡਿੰਗ ਹੀ ਇਨਫੋਰਮੇਸ਼ਨ ਚਾਹੀਦੀ ਸੀਗੀ ਸਰ ਐਕਚੁਲੀ ਜੋ ਬਾਈਸਾਈਕਲ ਮੈਂ ਆਪਣੇ ਛੋਟੇ ਬ੍ਰਦਰ ਲਈ ਬਾਏ ਕਰਨੀ ਸੀਗੀ ਅਤੇ ਬਜਟ ਸਰ ਮਤਲਬ ਜਿਵੇਂ ਉਹਨੇ ਨਿਊ ਮਾਡਲ 'ਚ ਹੀ ਲੈਣੀ ਹੈ ਬਾਈਸਾਈਕਲ ਅਤੇ ਐਕਚੁਲੀ ਮੈਨੂੰ ਇਹ ਨਹੀਂ ਪਤਾ ਹੈਗਾ ਕਿ ਮਤਲਬ ਵੀ ਕੀ ਰੀ ਰੇਟ ਕੀ ਚੱਲ ਰਿਹਾ ਬਾਈਸਾਈਕਲਸ 'ਤੇ ਕਿਉਂਕਿ ਮੈਂ ਫਸਟ ਟਾਈਮ ਹੀ ਬਾਏ ਕਰਨੀ ਹੈ ਸੋ ਸਰ ਅਗਰ ਤੁਸੀਂ ਮੈਨੂੰ ਥੋੜ੍ਹਾ ਆਈਡੀਆ ਦੇ ਦੋ ਹੈ ਨਾ ਕਿ ਜੋ ਗੇਅਰਾਂ ਵਾਲੀ ਹੁੰਦੀ ਆ ਜਾਂ ਵਿਦਆਊਟ ਗੇਅਰਸ ਹੁੰਦੀ ਆ ਮਤਲਬ ਅੱਜ ਕੱਲ੍ਹ ਦੀ ਜਨਰੇਸ਼ਨ ਲਈ ਕਿਵੇਂ ਦੀ ਬਾਈਸਾਈਕਲ ਅੱਛੀਆਂ ਰਹਿੰਦੀਆਂ ਪਰ ਜਿਹੜੀਆਂ ਬੱਚਿਆਂ ਨੂੰ ਜ਼ਿਆਦਾ ਪਸੰਦ ਆਉਣ ਉਹਨਾਂ ਦਾ ਮਤਲਬ ਕਿੰਨਾ ਕੁ ਰੇਟ ਹੁੰਦਾ ਹੈ ਉਹ ਤੁਸੀਂ ਥੋੜਾ ਆਈਡੀਆ ਦੇ ਦਿਉ ਤਾਂ ਫਿਰ ਮੈਂ ਹਾਂਜੀ ਹਾਂਜੀ

ਹਾਂਜੀ ਹਾਂਜੀ ਹਾਂਜੀ ਉਹਦੀ ਚੌਦਾਂ ਪੰਦਰਾਂ ਕੁ ਸਾਲ ਹੈ ਜੀ ਠੀਕ ਹੈ ਸਰ ਹਾਂਜੀ ਓਕੇ ਸਰ

ਹਾਂਜੀ ਹਾਂਜੀ ਠੀਕ ਹੈ ਸਰ ਅਤੇ ਸਰ ਆਪਣੇ ਪਾਸ ਹੁਣ ਅਵੇਲੇਬਲ ਹੈ ਅਗਰ ਮੈਂ ਥੋੜ੍ਹਾ ਸਟੋਰ ਵਿਜਿਟ ਕਰਨਾ ਹੋਵੇ ਤਾਂ ਮੈਨੂੰ ਮਿਲ ਸਕਦੀ ਹੁਣ ਬਾਈਸਾਈਕਲ ਹਾਂਜੀ ਠੀਕ ਹੈ ਸਰ ਓਕੇ ਸਰ ਅਤੇ ਸਰ ਐਡਰੈੱਸ ਮੇਨ ਲੀਲਾ ਭਵਨ ਹੀ ਹੈ ਹੈ ਨਾ ਓਕੇ ਓਕੇ ਸਰ ਠੀਕ ਹੈ ਸਰ ਠੀਕ ਹੈ ਥੈਂਕ ਯੂ ਸਰ ਥੈਂਕ ਯੂ ਸੋ ਮੱਚ ਓਕੇ ਸਰ